ਮੈਂ ਰਾਕੇਸ਼ ਸੁਜਾਨਪੁਰ ਵਾਸੀ ਜ਼ਿਲ੍ਹਾ ਪਠਾਨਕੋਟ ਤੋਂ ਬਿਲੋਂਗ ਕਰਦੀ ਹਾਂ ਸਾਡੇ ਇਲਾਕੇ ਦੀਆਂ ਬਹੁਤ ਹੀ ਇਤਿਹਾਸਿਕ ਘਟਨਾਵਾਂ ਜਿਹੜੀਆਂ ਹਨ ਉਹ ਇੱਥੇ ਵਾਪਰੀਆਂ ਹਨ ਜਿਵੇਂ ਕਿ ਸਾਡੇ ਇੱਥੇ ਲਾਗੇ ਹੀ ਪਰੀਆਂ ਵਾਲਾ ਬਾਗ ਹੈ ਉਹ ਵੀ ਇੱਕ ਇਤਿਹਾਸਿਕ ਸਥਾਨ ਹੈ ਇਤਿਹਾਸਿਕ ਕਿਵੇਂ ਕਹਿ ਸਕਦੇ ਹਾਂ ਕਿ ਜਿਸ ਸਮੇਂ ਉੱਨੀ ਸੌ ਸਨਤਾਲੀ ਦੀ ਵੰਡ ਤੋਂ ਪਹਿਲਾਂ ਉੱਥੇ ਕੀ ਸੀਗਾ ਕਿ ਅੰਗਰੇਜ਼ਾਂ ਦੀਆਂ ਜਿਹੜੀਆਂ ਛਾਉਣੀਆਂ ਹਨ ਉਹ ਬਣੀਆਂ ਹੋਈਆਂ ਹਨ ਅੱਜ ਵੀ ਉੱਥੇ ਹੈ ਨੇ ਅਤੇ ਉੱਥੋਂ ਜਿਹੜਾ ਪਾਣੀ ਦਾ ਨਿਕਾਸ ਹੈ ਜਿਹੜੀ ਨਹਿਰ ਦਾ ਨਿਕਾਸ ਹੈ ਉਹ ਅੰਗਰੇਜ਼ਾਂ ਦੇ ਦੁਆਰਾ ਹੀ ਬਣਾਇਆ ਗਿਆ ਹੈ ਉਹ ਜਿਹੜੀ ਲਿੰਕ ਨਹਿਰ ਹੈ ਉਹ ਇੱਥੋਂ ਤੋਂ ਬਿਆਸ ਲਿੰਕ ਨਹਿਰ ਹੈ ਰਾਵੀ ਤੋਂ ਬਿਆਸ ਲਿੰਕ ਨਹਿਰ ਹੈ ਉਹ ਇਤਿਹਾਸਿਕ ਨਹਿਰ ਹੈ ਉਹ ਅੰਗਰੇਜ਼ਾਂ ਦੇ ਦੁਆਰਾ ਹੀ ਬਣਾਈਆ ਗਈਆਂ ਹਨ ਇਹ ਕਹਾਣੀਆਂ ਅਸੀਂ ਆਪਣੇ ਵੱਡਿਆਂ ਤੋਂ ਵੀ ਸੁਣਦੇ ਆਏ ਹਾਂ ਇੱਕ ਹੋਰ ਹੈ ਕਿ ਸਾਡੇ ਇਲਾਕੇ ਨਾਲ ਇਹ ਗੱਲ ਵੀ ਲੱਗਦੀ ਹੈ ਕਿ ਜੋ ਪਠਾਨਕੋਟ ਹੈ ਇਹ ਪਠਾਣਾਂ ਦਾ ਸ਼ਹਿਰ ਸੀ ਕਿ ਜਿੰਨੇ ਪਾ ਉੱਨੀ ਸੌ ਸੰਤਾਲੀ ਤੋਂ ਪਹਿਲਾਂ ਜੋ ਵੀ ਪਠਾਨ ਲੋਕ ਸਨ ਉਹ ਪਠਾਨਕੋਟ ਦੇ ਵਿੱਚ ਹੀ ਰਹਿੰਦੇ ਸਨ ਜਿਸ ਦੇ ਕਾਰਨ ਸਾਡੇ ਸ਼ਹਿਰ ਦਾ ਨਾਮ ਹੀ ਉਹਨਾਂ ਦੇ ਨਾਮ ਤੋਂ ਪੈ ਗਿਆ ਪਠਾਨਕੋਟ ਭਾਵ ਕਿ ਪਠਾਣਾਂ ਦਾ ਸ਼ਹਿਰ ਔਰ ਸਾਨੂੰ ਅੱਜ ਸਾਨੂੰ ਵਿਰਸੇ ਦੇ ਵਿੱਚ ਉਹਨਾਂ ਦੇ ਨਾਮ ਜਿਹੜਾ ਹੈ ਮਿਲਿਆ ਹੈ ਪਠਾਣਾਂ ਦੇ ਨਾਮ ਤੋਂ ਹੀ ਅੱਜ ਅਸੀਂ ਪਠਾਨਕੋਟ ਤੋਂ ਜਾਣੇ ਜਾਂਦੇ ਹਾਂ ਇਸੇ ਤਰ੍ਹਾਂ ਹੀ ਸਾਡੇ ਇੱਕ ਇਤਿਹਾਸ ਇਤਿਹਾਸਿਕ ਘਟਨਾ ਹੋਰ ਵੀ ਹੈ ਕਿ ਸਾਡਾ ਜਿਹੜਾ ਬੋਰਡਰ ਹੈ ਜੰਮੂ ਦੇ ਨਾਲ ਸੁਜਾਨਪੁਰ ਤੋਂ ਮਾਧੋਪੁਰ ਜਿਹੜਾ ਹੈ ਮਾਧੋਪੁਰ ਦਾ ਇਲਾਕਾ ਜਿਹੜਾ ਹੈ ਉਹ ਜੰਮੂ ਬੋਰਡਰ ਦਾ ਇਲਾਕਾ ਹੈ ਅਤੇ ਜੰਮੂ ਅਤੇ ਪਠਾਨਕੋਟ ਦੀ ਜਿਹੜੀ ਸ਼ਹਿਰ ਹੈ ਪੰਜਾਬ ਦਾ ਉਹ ਜਿਹੜੀ ਹੱਦ ਹੈ ਉਹ ਪੰਜਾਬ ਦੀ ਹੱਦ ਹੈ ਉੱਧਰੋਂ ਸਾਡੀ ਜੰਮੂ ਦੀ ਹੱਦ ਹੈ ਅਤੇ ਇਹ ਵਾਲਾ ਜਿਹੜਾ ਏਰੀਆ ਸੀ ਇੱਥੇ ਜਦੋਂ ਅਸੀਂ ਪਹਿਲਾਂ ਜੰਮੂ ਜਾਣਾ ਹੁੰਦਾ ਸੀ ਤਾਂ ਸਾਨੂੰ ਇੱਕ ਪਾਸ ਦੀ ਲੋੜ ਪੈਂਦੀ ਸੀ ਪਰ ਅੱਜ ਇਹ ਚੀਜ਼ ਨਹੀਂ ਹੈ ਇਹ ਵੀ ਇੱਕ ਇਤਿਹਾਸਿਕ ਘਟਨਾ ਦੇ ਨਾਲ ਹੀ ਅਸੀਂ ਇਸਨੂੰ ਜਾਣ ਸਕਦੇ ਹਾਂ ਧੰਨਵਾਦ